ਅਕਸਰ ਪ੍ਰੋਡਕਟ ਯੂਜ਼ ਕਰਕੇ ਮੇਰੇ ਨਾਲ ਬਹੁਤ ਦਿੱਕਤਾਂ ਹੋਈਆਂ ਨੇ ਪਰ ਜਿਹੜੀ ਸਭ ਤੋਂ ਵੱਧ ਦਿੱਕਤ ਮੈਨੂੰ ਆਈ ਹੈ ਉਹ ਇੱਕ ਗਾਰਨੀਅਰ ਦੀ ਫੇਸ ਕਰੀਮ ਯੂਜ਼ ਕਰਕੇ ਆਈ ਸੀ ਮੈਂ ਸ ਧੁੱਪ ਵਿੱਚ ਕੰਮ ਕਰਦਾ ਹਾਂ ਅਤੇ ਮੈਂ ਡੀਟੈਨ ਕਰੀਮ ਗਾਰਨੀਅਰ ਦੀ ਲਿੱਤੀ ਜਿਸ ਨਾਲ ਕਿ ਮੇਰੇ ਫੇਸ ਦੇ ਉੱਤੋਂ ਜਿਹੜੀ ਹੈ ਧੁੱਪ ਨਾਲ ਜੰਮੀ ਕਾਲਸ ਅਤੇ ਉਸਦੀ ਪਰਤ ਉਤਰ ਜਾਵੇ ਅਤੇ ਮੈਂ ਉਹ ਕਰੀਮ ਆਪਣੇ ਮੂੰਹ ਉੱਤੇ ਲਾਈ ਅਤੇ ਉਸ ਤੋਂ ਬਾਅਦ ਮੇਰੇ ਸਾਰੇ ਮੂੰਹ ਉੱਤੇ ਦਾਣੇ ਹੋਣ ਲੱਗ ਪਏ ਮੈਂ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗਾ ਕੀ ਮੈਂ ਇਹ ਪ੍ਰੋਡਕਟ ਕਿਉਂ ਵਰਤਿਆ ਜਿਸ ਕਾਰਨ ਮੈਨੂੰ ਉਹ ਇੱਕ ਮਹੀਨੇ ਤੱਕ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਡਾਕਟਰ ਕਾਰਨ ਫਿਰ ਮੈਂ ਗਾਰਨੀਅਰ ਦੇ ਏ ਮੇ ਕੰਪਨੀ ਵਿੱਚ ਮੇਲ ਕੀਤੀ ਕਿ ਉਹਨਾਂ ਦਾ ਇਹ ਪ੍ਰੋਡਕਟ ਮੈਂ ਯੂਜ਼ ਕਰਕੇ ਮੈਨੂੰ ਹੈਲਥ ਦੀ ਬਹੁਤ ਬੜੀ ਸਮੱਸਿਆ ਆਈ ਅਤੇ ਉਹ ਵੀ ਅੱਗੇ ਲੋਕਾਂ ਲਈ ਧਿਆਨ ਨਾਲ ਇਹੇ ਜਿਹੇ ਪ੍ਰੋਡਕਟ ਬਣਾਉਣ